ਮੈਂ ਸਭ ਤੋਂ ਪਹਿਲਾਂ ਜਿਹੜੇ ਐਮਾਜੋਨ ਇੱਕ ਐਪ ਹੈ ਉਹਦੇ ਤੋਂ ਬੂਟ ਮੰਗਵਾਏ ਸੀ ਜਿਨ੍ਹਾਂ ਦਾ ਸਾਈਜ਼ ਵੀ ਬਿਲਕੁਲ ਸਹੀ ਰਿਹਾ ਔਰ ਉਹਦਾ ਮਟੀਰੀਅਲ ਵੀ ਬਹੁਤ ਵਧੀਆ ਸੀ ਔਰ ਉਹਨੂੰ ਅਸੀਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਅੱਠ ਤੋਂ ਨੌਂ ਮਹੀਨੇ ਹੰਢਾਇਆ ਔਰ ਹੰਢਾਈ ਵੀ ਬਹੁਤ ਵਧੀਆ ਰਹੀ ਉਹਦੀ ਮਟੀਰੀਅਲ ਇੰਨਾ ਕੁ ਵਧੀਆ ਸੀ ਕਿ ਪੈਰ 'ਚ ਪਾਇਆ ਵੀ ਲਾਈਟ ਸੀ ਮਤਲਬ ਕੁਛ ਹੁੰਦੇ ਆ ਬੂਟ ਜਿਹੜੇ ਬਹੁਤ ਜ਼ਿਆਦਾ ਭਾਰੇ ਹੋ ਜਾਂਦੇ ਨੇ ਉਹ ਭਾਰੇ ਨਹੀਂ ਸੀ ਬਹੁਤ ਹਲਕੇ ਸੀ ਬੂਟ ਔਰ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਹੋਰ ਵੀ ਪ੍ਰੋਡਕਟ ਬੜੇ ਖਰੀਦੇ ਨੇ ਉਹਨਾਂ ਕੋਲੋਂ ਅਤੇ ਮੇਰਾ ਐਮਾਜ਼ੋਨ ਦੇ ਨਾਲ ਆਪਣਾ ਪਹਿਲਾ ਜਿਹੜਾ ਪ੍ਰੋਡੈਕਟ ਲਿਆ ਸੀ ਉਹਦਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ